ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਮੈਂ ਅਮਨਦੀਪ ਪਿਛਲੇ ਹਫ਼ਤੇ ਚੌਦਾਂ ਤਰੀਕ ਚੌਦਾਂ ਦਸੰਬਰ ਨੂੰ ਮੇਰਾ ਜਨਮਦਿਨ ਸੀ ਅਸੀਂ ਤੁਹਾਡੇ ਅਨੇਜਾ ਰੈਸਟੋਰੈਂਟ 'ਚ ਆਏ ਸੀ ਤੁਹਾਡਾ ਫੂਡ ਬਹੁਤ ਵਧੀਆ ਸੀ ਇਸ ਤੋਂ ਪਹਿਲਾਂ ਵੀ ਅਸੀਂ ਅਕਸਰ ਆਉਂਦੇ ਰਹਿੰਦੇ ਹਾਂ ਅਤੇ ਉਸ ਤਰ੍ਹਾਂ ਅਸੀਂ ਤੁਹਾਡਾ ਮਿਕਸ ਵੈੱਜ ਦਾਲ ਮੱਖਣੀ ਅਤੇ ਪਨੀਰ ਦੀਆਂ ਕੁਛ ਆਈਟਮਸ ਵਗੈਰਾ ਮਤਲਬ ਟੇਸਟ ਕੀਤੀਆਂ ਸੀ ਜੋ ਕਿ ਬਹੁਤ ਵਧੀਆ ਸੀ ਅਤੇ ਸੇਮ ਹੀ ਅੱਜ ਮੇਰੀ ਬੈਸਟ ਫਰੈਂਡ ਦਲਜੀਤ ਦਾ ਹੈਪੀ ਬਰਥਡੇ ਆ ਜਨਮਦਿਨ ਹੈ ਤਾਂ ਅਸੀਂ ਸੇਮ ਔਡਰ ਰਿਪੀਟ ਕਰਨਾ ਹੈ ਅਤੇ ਪਲੀਜ਼ ਕਿਰਪਾ ਕਰਕੇ ਤੁਸੀਂ ਸਾਨੂੰ ਸਿਮੀਲਰ ਚੌਦਾਂ ਦਸੰਬਰ ਵਾਲਾ ਜੋ ਵੀ ਮੈਨਿਊ 'ਚ ਅਸੀਂ ਆਈਟਮਸ ਲਈਆਂ ਸੀ ਉਹ ਵਾਲੀਆਂ ਆਈਟਮਸ ਹੀ ਦੁਬਾਰਾ ਮਤਲਬ ਸਾਨੂੰ ਡਿਲੀਵਰ ਕਰ ਦਿਉ ਤਾਂ ਐਡਰੈਸ ਮੈਂ ਤੁਹਾਨੂੰ ਬੋਲ ਦਿੰਦੀ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਸਟਲ ਮਾਤਾ ਗੁਜਰੀ ਹੋਸਟਲ ਦੇ ਵਿੱਚ ਤਾਂ ਅਸੀਂ ਪਿੱਕ ਕਰ ਲਵਾਂਗੇ ਇੱਕ ਹੋਰ ਕੁਛ ਐਡ ਕਰ ਸਕਦੇ ਹਾਂ ਜਿਵੇਂ ਕਿ ਇੱਕ ਤਾਂ ਸਾਨੂੰ ਗੁਲਾਬ ਜਾਮੁਨ ਐਡ ਕਰ ਦੇਣਾ ਅਤੇ ਇੱਕ ਬਰਾਉਨੀਸ ਐਡ ਕਰ ਦੇਣਾ ਉਸ ਔਡਰ ਦੇ ਵਿੱਚ ਬਾਕੀ ਤੁਹਾਨੂੰ ਜੋ ਕੁਛ ਵੀ ਅਸੀਂ ਉਸ ਦਿਨ ਔਡਰ ਕੀਤਾ ਸੀ ਸੇਮ ਔਡਰ ਰਿਪੀਟ ਕਰ ਦਿਉ ਥੈਂਕ ਯੂ ਸਰ ਥੈਂਕ ਯੂ